ਸਾਨੂੰ ਪੇਂਡੂ ਖੇਤੀਬਾੜੀ ਵਿੱਚ ਜਾਂ ਕਾਰੋਬਾਰ ਅਸੀਂ ਕਰ ਸਕਦੇ ਹਾਂ ਕਰਨਾ ਵੀ ਚਾਹੀਦਾ ਹੈ ਕਿ ਪਿੰਡਾਂ ਵਿੱਚ ਆਮ ਤੌਰ 'ਤੇ ਇਹ ਚੀਜਾਂ ਨਹੀਂ ਮਿਲਦੀਆਂ ਪਰ ਸਾਨੂੰ ਕਿਸਾਨਾਂ ਵਾਸਤੇ ਪਿੰਡਾਂ ਦੇ ਵਿੱਚ ਖਾਦ ਦੀਆਂ ਦੁਕਾਨਾਂ ਆਦਿ ਦੀਆਂ ਖੋਲ੍ਹਣੀਆਂ ਚਾਹੀਦੀਆਂ ਹਨ ਇਹ ਪੇਂਡੂ ਲੋਕਾਂ ਵਾਸਤੇ ਬਹੁਤ ਹੀ ਫਾਇਦੇਮੰਦ ਅਤੇ ਕਾਰੋਬਾਰ ਵਾਲਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਉਨ੍ਹਾਂ ਨੂੰ ਖਾਦ ਬੀਜ ਆਦਿ ਦੀ ਦੁਕਾਨਾਂ ਖੋਲ੍ਹਣੀਆਂ ਚਾਹੀਦੀਆਂ ਹਨ ਤਾਂ ਕਿ ਪੇਂਡੂ ਲੋਕਾਂ ਨੂੰ ਉਨ੍ਹਾਂ ਹੀ ਦੁਕਾਨਾਂ ਤੋਂ ਇਹ ਸਹੂਲਤ ਮਿਲ ਸਕੇ ਉਨ੍ਹਾਂ ਨੂੰ ਵੀ ਬਜ਼ਾਰ ਆਦਿ ਜਾਣ ਦੀ ਲੋੜ ਨਾ ਪਵੇ ਅਤੇ ਔਰ ਹ ਜੇ ਹੱਲ ਕਿਰਾਇਆ ਆਦਿ ਇਨ੍ਹਾਂ ਦਾ ਵੀ ਸਮਾਨ ਉਨ੍ਹਾਂ ਨੂੰ ਉੱਥੇ ਹੀ ਮਿਲ ਸਕੇ ਹੱਲ ਵਗੈਰਾ ਟਰੈਕਟਰ ਆਦਿ ਦੀ ਰਿਪੇਅਰਿੰਗ ਆਪਾਂ ਖੇਤਾਂ ਵਿੱਚ ਹੀ ਕਰਵਾ ਸਕੀਏ ਸਪਰੇਅ ਵਾਲੀ ਟੈਂਕੀਆਂ ਆਦਿ ਦੀ ਦੁਕਾਨਾਂ ਪਿੰਡਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨਾਂ ਨੂੰ ਵਧੀਆ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਮਿਲ ਸਕੇ ਅਤੇ ਉਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਟੈਮ ਬਚ ਸਕੇ